ਮੋਹਾਲੀ ਜ਼ਿਲ੍ਹੇ ਵਿੱਚ ਵੈਸੇ ਤਾਂ ਲੋਕ ਸਾਲ ਭਰ ਹੀ ਆਪਣਾ ਸਮਾਂ ਬਿਤਾਉਣ ਲਈ ਆ ਸਕਦੇ ਹਨ ਪਰ ਜੇਕਰ ਇੱਕ ਖਾਸ ਨਿਰਧਾਰਤ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਚੰਡੀਗੜ੍ਹ ਵਿੱਚ ਰੋਜ਼ ਗਾਰਡਨ ਵਿੱਚ ਰੋਜ਼ ਫੈਸਟੀਵਲ ਜੋ ਕਿ ਫ਼ਰਵਰੀ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਅਤੇ ਅਲੱਗ ਅਲੱਗ ਫੁੱਲਾਂ ਦੀਆਂ ਕਿਸਮਾਂ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ ਉਸ ਵੇਲ਼ੇ ਜ਼ਰੂਰ ਆ ਸਕਦੇ ਹਨ ਕਿਉਂਕਿ ਉਹ ਇੱਕ ਤਿਉਹਾਰ ਵਾਂਗ ਹੀ ਮਨਾਇਆ ਜਾਂਦਾ ਹੈ ਅਤੇ ਇਹ ਫੈਸਟੀਵਲ ਦੋ ਤੋਂ ਚਾਰ ਦਿਨ ਚੱਲਦਾ ਹੈ ਅਤੇ ਅਕਤੂਬਰ ਅਤੇ ਨਵੰਬਰ ਦੇ ਮਹੀਨੇ ਵਿੱਚ ਜੋ ਕਿ ਤਿਉਹਾਰਾਂ ਦੇ ਮਹੀਨੇ ਹੁੰਦੇ ਹਨ ਉਹ ਵੀ ਇਸ ਜ਼ਿਲ੍ਹੇ ਵਿੱਚ ਧੂਮ ਧਾਮ ਨਾਲ਼ ਮਨਾਏ ਜਾਂਦੇ ਹਨ ਦੀਵਾਲੀ ਦੇ ਸਮੇਂ ਦੁਰਗਾ ਪੂਜਾ ਕੀਤੀ ਜਾਂਦੀ ਹੈ ਤਾਂ ਮੇਰੀ ਸਲਾਹ ਇਹੀ ਹੈ ਜੇਕਰ ਲੋਕਾਂ ਨੇ ਘੁੰਮਣ ਆਉਣਾ ਹੈ ਤਾਂ ਉਹ ਰੋਜ਼ ਫੈਸਟੀਵਲ ਜਾਂ ਅਕਤੂਬਰ ਨਵੰਬਰ ਦੇ ਮਹੀਨੇ ਵਿੱਚ ਆ ਸਕਦੇ ਹਨ